ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਖੇਡਾਂ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਬਲਵਾਨ ਬਣਾਉਂਦੀਆਂ ਹਨ ਹਰ ਇਨਸਾਨ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਖੇਡ ਤੋਂ ਪ੍ਰਭਾਵਿਤ ਹੁੰਦਾ ਹੈ ਅਤੇ ਉਸ ਖੇਡ ਨੂੰ ਖੇਡਦਾ ਹੈ ਇਸੇ ਪ੍ਰਕਾਰ ਹੀ ਮੈਨੂੰ ਵੀ ਇੱਕ ਨਵੀਂ ਖੇਡ ਮਿਲੀ ਮੋਬਾਈਲ ਦੇ ਉੱਪਰ ਜਿਹਦਾ ਨਾਮ ਹੈ ਹੇਡੇ ਇਹ ਕਿਸਾਨੀ ਖੇਡ ਹੈ ਇਹਦੇ ਵਿੱਚ ਫ਼ਸਲਾਂ ਬੀਜਣ ਨੂੰ ਕੱਟਣ ਵੱਢਣ ਆਪਣੇ ਫਾਰਮ ਨੂੰ ਸੋਹਣਾ ਬਣਾਉਣ ਅਤੇ ਉਹਨੂੰ ਵਧੀਆ ਤਰੀਕੇ ਦੇ ਨਾਲ ਰੱਖਣ ਲਈ ਉਹਨਾਂ ਫ਼ਸਲਾਂ ਨੂੰ ਵੇਚਣ ਦੇ ਲਈ ਫ਼ਸਲਾਂ ਤੋਂ ਕੀ ਕੀ ਬਣਾ ਸਕਦੇ ਹਾਂ ਇਹ ਸਭ ਸਿੱਖਿਆ ਇਹ ਇਕ ਨਵੀਨਤਮ ਖੇਡ ਸੀ ਜਿਹੜੀ ਕਿ ਮੈਨੂੰ ਬਹੁਤ ਹੀ ਭਾਈ ਮੈਂ ਇਸ 'ਤੇ ਇੱਕ ਸੌ ਅੱਠ ਲੈਵਲ ਕੰਪਲੀਟ ਕਰ ਚੁੱਕਾ ਹਾਂ ਅਤੇ ਇਹ ਗੇਮ ਜਿਹੜੀ ਹੈ ਆਪਣੇ ਆਪ ਵਿੱਚ ਹੀ ਇੱਕ ਨਵੀਨਤਮ ਹੈ ਸ਼ਾਨਦਾਰ ਹੈ ਕੋਈ ਹੜਬੜਾਹਟ ਨਹੀਂ ਹੁੰਦੀ ਹਾਂ ਮੈਂ ਜਲਦੀ ਜਲਦੀ ਇਹਦਾ ਲੈਵਲ ਕੰਪਲੀਟ ਕਰਾਂ ਨਾ ਬਹੁਤ ਹੀ ਆਰਾਮ ਨਾਲ ਤੁਹਾਨੂੰ ਸਿੱਖਣ ਲਈ ਮਿਲੇਗਾ ਕਿ ਆਹ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ ਆਹ ਚੀਜ਼ ਬਣਾਉਣ ਦੇ ਲਈ ਅਤੇ ਇਹਨਾਂ ਚੀਜ਼ਾਂ ਤੋਂ ਆਹ ਬਣਦਾ ਫ਼ਸਲ ਕਿਵੇਂ ਬੀਜਣੀ ਹੈ ਫ਼ਸਲ ਕਦੋਂ ਵੱਢਣੀ ਹੈ ਫ਼ਸਲ ਦਾ ਕੀ ਕੀ ਹੋਏਗਾ ਫ਼ਸਲਾਂ ਨੂੰ ਕਿੰਨਾ ਟਾਈਮ ਲੱਗੇਗਾ ਫ਼ਸਲਾਂ ਦਾ ਕਿਵੇਂ ਵੇਚਣਾ ਹੈ ਫਸਲਾਂ ਦਾ ਕੀ ਕਰਨਾ ਹੈ ਕਿੰਨਾ ਮੁੱਲ ਮਿਲੇਗਾ ਸੋ ਮੈਨੂੰ ਤਾਂ ਬਹੁਤ ਭਾਈ ਤੁਸੀਂ ਵੀ ਖੇਡ ਕੇ ਜ਼ਰੂਰ ਦੇਖਿਓ ਧੰਨਵਾਦ